ਵਿਦਿਆਰਥੀ ਦੂਸਰੇ ਕਸਬਿਆਂ ਦੇ ਸਕੂਲਾਂ ਜਾਂ ਹਾਈ ਸਕੂਲਾਂ ਵਿੱਚ ਬੱਸਾਂ ਰਾਹੀਂ ਜਾਂਦੇ ਹਨ ਪ੍ਰਾਈਵੇਟ ਸਾਧਨਾਂ ਰਾਹੀਂ ਜਾਂਦੇ ਹਨ ਆਟੋ ਟੈਂਪੂ ਕਈ ਪ੍ਰਕਾਰ ਦੇ ਰਿਕਸ਼ੇ ਵਗੈਰਾ ਲੱਗੇ ਹੋਏ ਨੇ ਜਿਹੜੇ ਬੱਚਾ ਬੱਚਿਆਂ ਨੂੰ ਉਹਨਾਂ ਦੇ ਸਕੂਲਾਂ ਤੱਕ ਪਹੁੰਚਾਉਂਦੇ ਹਨ ਜਾਂ ਬੱਚਿਆਂ ਕੋਲ ਆਪਣੇ ਸਾਈਕਲ ਹਨ ਮਾਈ ਭਾਗੋ ਸਕੀਮ ਦੇ ਤਹਿਤ ਬੱਚਿਆਂ ਨੂੰ ਸਾਇਕ ਫਰੀ ਸਾਈਕਲ ਸਰਕਾਰਾਂ ਵੱਲੋਂ ਮੁਹੱਈਆ ਕੀਤੇ ਗਏ ਸੀ ਜਿਨ੍ਹਾਂ ਦਾ ਪ੍ਰਯੋਗ ਬੱਚੇ ਸਕੂਲਾਂ ਵਿੱਚ ਜਾਣ ਲਈ ਕਰਦੇ ਹਨ ਇਸ ਤੋਂ ਇਲਾਵਾ ਕੁਝ ਘਰਾਂ ਵਿੱਚ ਮੋਟਰਸਾਈਕਲ ਵੀ ਹਨ ਕੁਝ ਬੱਚਿਆਂ ਕੋਲ ਮੋਟਰਸਾਈਕਲ ਵਗੈਰਾ ਸਕੂਟੀਆਂ ਆਟੋ ਐ ਸੋਰੀ ਐਕਟਿਵਾ ਵਗੈਰਾ ਹਨ ਜਿਨ੍ਹਾਂ ਤੋਂ ਦੂਸਰੇ ਸਕੂਲਾਂ ਵਿੱਚ ਜਾਂਦੇ ਹਨ ਹਾਂ ਬਹੁਤੇ ਪਿੰਡਾਂ ਵਿੱਚ ਨਿਯਮਿਤ ਬੱਸਾਂ ਨਹੀਂ ਹਨ ਜਿਹੜੀਆਂ ਉਹਨਾਂ ਨੂੰ ਸਕੂਲ ਪਹੁੰਚਾ ਸਕਣ ਟਾਈਮ ਟੂ ਟਾਈਮ ਫਿਰ ਵੀ ਕੁਝ ਬੱਸਾਂ ਅਜਿਹੀਆਂ ਹਨ ਉਸ ਟਾਈਮ ਜਿਹੜੀਆਂ ਸਕੂਲ ਦੇ ਟਾਈਮ ਨਾਲ਼ ਮੈਚ ਕਰਦੀਆਂ ਹਨ ਚੰਗੀ ਗੁਣਵੱਤਾ ਵਾਲੀ ਸਿੱਖਿਆ ਪ੍ਰਾਪਤ ਕਰਨਾ ਅੱਜ ਕ ਅਜੋਕੇ ਸਮੇਂ ਵਿੱਚ ਇੰਨਾਂ ਔਖਾ ਨਹੀਂ ਰਿਹਾ ਹਰ ਜਿਹਨੇ ਪੜ੍ਹਨਾ ਹੈ ਜਿਹਨੇ ਵਿੱਦਿਆ ਪ੍ਰਾਪਤ ਕਰਨੀ ਹੈ ਉਹ ਕੋਈ ਨਾ ਕੋਈ ਸਾਧਨ ਅਰੇਂਜ ਸਾਧਨ ਦਾ ਪ੍ਰਬੰਧ ਕਰ ਹੀ ਲੈਂਦਾ ਹੈ ਹਰੇਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੱਜ ਕੱਲ੍ਹ ਸਮਾਜ ਵਿੱਚ ਇਹੋ ਮਦਦਗਾਰ ਲੋਕ ਵੀ ਸ਼ਾਮਿਲ ਹਨ ਧੰਨਵਾਦ